ਦੇਖੋ ਮਾਰਸ਼ਲ ਆਰਟ ਦੀ ਸੱਭਿਆਚਾਰਕ ਅਤੇ ਜੇ ਇਤਿਹਾਸਿਕ ਮਹੱਤਤਾ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਇਹਦੇ ਬਾਰੇ ਕੁਝ ਵੈਸੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈਗੀ ਹੁਣ ਜੇ ਦੇਖੋ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਜਿਹੜੇ ਸਕੂਲ ਹੈਗੇ ਨੇ ਪ੍ਰਾਈਵੇਟ ਸਕੂਲਜ਼ ਹੈਗੇ ਨੇ ਤਾਂ ਅੱਜ ਕੱਲ੍ਹ ਦੇਖੋ ਹਰ ਸਕੂਲ ਦੇ ਵਿੱਚ ਜਿੱਥੇ ਮੈਨੂੰ ਲੱਗਦਾ ਬੱਚੇ ਮਤਲਬ ਜਾਗਰੂਕ ਹੋ ਰਹੇ ਨੇ ਇਹਦੇ ਬਾਰੇ ਪਰ ਦੇਖੋ ਜਿਹੜੇ ਸਮਿਆਂ ਦੇ ਵਿੱਚ ਅਸੀਂ ਪੜ੍ਹੇ ਹਾਂ ਤਾਂ ਉਦੋਂ ਦੇਖੋ ਕੋਈ ਮਤਲਬ ਇੱਦਾਂ ਮਤਲਬ ਸਾਨੂੰ ਨਹੀਂ ਸਿੱਖਿਅਤ ਕੀਤਾ ਜਾਂਦਾ ਸੀ ਇਹਦੇ ਬਾਰੇ ਹੁਣ ਦੇਖੋ ਜਦੋਂ ਸਾਡੀ ਪੜ੍ਹਾਈ ਵੀ ਖਤਮ ਹੋ ਗਈ ਹੈ ਤਾਂ ਸਾਨੂੰ ਹੁਣ ਮਤਲਬ ਚੀਜ਼ਾਂ ਉਹ ਪਤਾ ਲੱਗਦੀਆਂ ਨੇ ਪਰ ਮੈਨੂੰ ਮਤਲਬ ਇਹਦੇ ਬਾਰੇ ਮੈਂ ਕੋਈ ਵਿਚਾਰ ਨਹੀਂ ਆਪਣੇ ਦੱਸ ਸਕਦੀ ਇਤਿਹਾਸਕ ਅਤੇ ਜੇ ਸੱਭਿਆਚਾਰਕ ਮਹੱਤਤਾ ਦੀ ਗੱਲ ਕੀਤੀ ਜਾਵੇ